ਵੀਰੇ ਤੁਸੀਂ ਐਮਾਜੋਨ ਕੰਪਨੀ ਤੋਂ ਬੋਲਦੇ ਹੋਗੇ ਅਸੀਂ ਤੁਹਾਨੂੰ ਨਾ ਇੱਕ ਹੈਡਫੋਨ ਔਡਰ ਪਾਇਆ ਸੀਗਾ ਵੀ ਸਾਨੂੰ ਵੀ ਜਲਦੀ ਭੇਜ ਦਿਓ ਅਤੇ ਤੁਸੀਂ ਔਡਰ ਬਹੁਤ ਲੇਟ ਭੇਜਿਆ ਸਾਡਾ ਸਾਡੇ ਕੋਲ ਟਾਈਮ ਹੈ ਨਹੀਂ ਸੀ ਸੋ ਇਸ ਲਈ ਤੁਹਾਨੂੰ ਅਸੀਂ ਔਡਰ ਪਾਇਆ ਸੀਗਾ ਅਤੇ ਹੈਡਫੋਨ ਤਾਂ ਪਹੁੰਚ ਗਏ ਸਾਡੇ ਕੋਲ ਇੱਕ ਤਾਂ ਉਹਨਾਂ ਦੀ ਪੈਕਿੰਗ ਬਹੁਤ ਮਾੜੀ ਸੀਗੀ ਵੀਰੇ ਅਤੇ ਇੱਕ ਹੈਡਫੋਨ ਅਸੀਂ ਦੋ ਘੰਟੇ ਚਲਾਇਆ ਅਤੇ ਇੱਕ ਹੈਡਫੋਨ ਖਰਾਬ ਵੀ ਹੋ ਗਿਆ ਅਤੇ ਤਾਰਾਂ ਵੀ ਬਾਹਲੀਆਂ ਲੰਬੀਆਂ ਉਹਦੀਆਂ ਅਤੇ ਪੈਕਿੰਗ ਵੀ ਬਾਹਲੀ ਬੇਕਾਰ ਜੀ ਸੀਗੀ ਅਤੇ ਅਸੀਂ ਤੁਹਾਨੂੰ ਜਲਦੀ ਭੇਜਣ ਵਾਸਤੇ ਔਡਰ ਪਾਇਆ ਸੀ ਕਿਉਂਕਿ ਸਾਡੇ ਕੋਲ ਬਾਜ਼ਾਰ ਜਾਣ ਦਾ ਟਾਈਮ ਨਹੀਂ ਸੀਗਾ ਅਤੇ ਤੁਸੀਂ ਕਿੰਨਾ ਲੇਟ ਸਾਨੂੰ ਹੈਡਫੋਨ ਭੇਜੇ ਹੈਗੇ ਇਹ ਤੋਂ ਵਧੀਆ ਤਾਂ ਸਾਨੂੰ ਇੱਥੋਂ ਬਾਜ਼ਾਰ 'ਚ ਵੀ ਮਿਲ ਜਾਂਦੇ ਹੈਡਫੋਨ ਅਤੇ ਹੁਣ ਸਾਡਾ ਇਸ ਤੋਂ ਮਨ ਅੱਕ ਗਿਆ ਵੀਰੇ ਬਸ ਅਸੀਂ ਤੁਹਾਡੀ ਕੰਪਨੀ ਛੱਡ ਰਹੇ ਹਾਂ ਅੱਜ ਤੋਂ ਬਾਅਦ ਅਸੀਂ ਨਹੀਂ ਕੁਛ ਮੰਗਵਾਉਂਦੇ